ਕੀ ਤੁਸੀਂ ਭੰਗੜੇ ਦੀ ਮਹੱਤਤਾ ਬਾਰੇ ਦੱਸ ਸਕਦੇ ਹੋ ਕਿ ਭੰਗੜਾ ਸਿਰਫ਼ ਪੰਜਾਬ ਵਿੱਚ ਹੀ ਪ੍ਰਚਲਿਤ ਹੈ ਜਾਂ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ ਹਾਂਜੀ ਮੈਂ ਭੰਗੜੇ ਦੀ ਮਹੱਤਤਾ ਬਾਰੇ ਦੱਸ ਸਕਦੀ ਹਾਂ ਭੰਗੜਾ ਸਿਰਫ਼ ਪੰਜਾਬ ਵਿੱਚ ਹੀ ਪ੍ਰਚਲਿਤ ਨਹੀਂ ਹੈ ਪੂਰੀ ਦੁਨੀਆ ਵਿੱਚ ਭੰਗੜਾ ਦੀ ਮਹੱਤਤਾ ਹੈ ਦੇਸ਼ ਵਿਦੇਸ਼ ਵਿੱਚ ਸਾਡੇ ਨੌਜਵਾਨ ਕੁੜੀਆਂ ਮੁੰਡੇ ਵੱਡੇ ਛੋਟੇ ਸਭ ਭੰਗੜੇ ਦਾ ਆਨੰਦ ਲੈਂਦੇ ਹਨ ਔਰ ਭੰਗੜੇ ਦੀ ਮਹੱਤਤਾ ਬਾਰੇ ਜਾਣਦੇ ਹਨ ਜੋ ਭੰਗੜੇ ਨਾਲ ਕਲਾਸਿਕਲ ਅਕੈਡਮ ਅਕੈਡਮੀਆਂ ਵੀ ਖੁੱਲ੍ਹੀਆਂ ਹਨ ਜੋ ਬੱਚਿਆਂ ਨੂੰ ਭੰਗੜੇ ਬਾਰੇ ਦੱਸਦੇ ਹਨ ਅਤੇ ਭੰਗੜਾ ਸਿਖਾਉਂਦੇ ਵੀ ਹਨ ਭੰਗੜਾ ਸਿਰਫ਼ ਦੇਸ਼ ਵਿੱਚ ਨਹੀਂ ਪੂਰੇ ਦੇਸ਼ ਵਿਦੇਸ਼ ਵਿੱਚ ਪ੍ਰਚਲਿਤ ਹੈ ਦੁਨੀਆ ਭਰ ਵਿੱਚ ਭੰਗੜੇ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ ਵਿਸਾਖੀ ਦੇ ਮੇਲੇ ਤੇ ਫਸਲ ਦੀ ਕਟਾਈ ਦੇ ਭੰਗੜੇ ਦਾ ਬੜੀ ਮਹੱਤਤਾ ਹੈ